ਮੈਂ ਨਵੀਂ ਚਿੱਤਰਕਾਰੀ ਬਣਾਉਣ ਲਈ ਆਪਣੀ ਪ੍ਰਕਿਰਿਆ ਦਾ ਵਰਣਨ ਕਰਦੀ ਹਾਂ ਮੈਂ ਸਭ ਤੋਂ ਪਹਿਲਾਂ ਚਾਟ ਨੂੰ ਸਟੈਂਡ ਦੇ ਵਿੱਚ ਲਗਾਉਂਦੀ ਹਾਂ ਫਿਰ ਉਸ ਵਿੱਚ ਜਿਹੜੇ ਕਲਰ ਕਰਨੇ ਹਨ ਉਹਨਾਂ ਨੂੰ ਸਲੈਕਟ ਕਰਦੀ ਹਾਂ ਚਿੱਤਰਕਾਰੀ ਬਣਾਉਣ ਲਈ ਔਨਲਾਈਨ ਤਸਵੀਰਾਂ ਅਤੇ ਕੰਪਿਊਟਰ ਦੇ ਉੱਤੇ ਬਣਾਉਣ ਲਈ ਜਾਂਦੀਆਂ ਹਨ ਜਿਵੇਂ ਕਿ ਕੰਪਿਊਟਰ ਵਿੱਚ ਪੇਂਟ ਹੋਰ ਵੀ ਟੂਲਸ ਹੁੰਦੇ ਹਨ ਜਿਹਨਾਂ ਵਿੱਚ ਤਸਵੀਰਾਂ ਬਣਾ ਬਣਾਈਆਂ ਹਨ ਆਨ ਆਫਲਾਈਨ ਸ੍ਰੋਤ ਪੁਰਾਣੀਆਂ ਕਿਤਾਬਾਂ ਤੋਂ ਵੇਖ ਕੇ ਉਹ ਵੀ ਤਸਵੀਰ ਬਣਾ ਲਈ ਦੀਆਂ ਹਨ ਹੁਣ ਹਾਲ ਵਿੱਚ ਹੀ ਮੈਂ ਕੰਪਿਊਟਰ ਦਾ ਮਾਡਲ ਤਿਆਰ ਕੀਤਾ ਹੈ ਅਤੇ ਉਸ ਵਿੱਚ ਥਰਮਲ ਦਾ ਗੱਤਾ ਅਤੇ ਚਾਟ 'ਤੇ ਵੱਖ ਵੱਖ ਤਰ੍ਹਾਂ ਦੇ ਕਲਰ ਅਤੇ ਯੂਜ ਕੀਤੇ ਆ ਅਤੇ ਉਸ ਨੂੰ ਬਹੁਤ ਹੀ ਸਲਾਹਿਆ ਗਿਆ ਅਤੇ ਉਹ ਹੁਣ ਲੈਬ ਵਿੱਚ ਲਗਾਇਆ ਗਿਆ ਹੈ ਜਿਸ ਕਰਕੇ ਸਕੂਲ ਦੇ ਪ੍ਰਿੰਸੀਪਲ ਨੇ ਵੀ ਬਹੁਤ ਸਲਾਹਿਆ ਹੈ ਅਤੇ ਕੰਪਿਊਟਰ ਲੈਬ ਵਿੱਚ ਉਹ ਹੁਣ ਮੌਜੂਦ ਹੈ